ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਜੀ ਹਾਂ ਸਕਿੰਨ ਟ੍ਰੀਟਮੈਂਟ ਵੈਸੇ ਸਾਡੇ ਕੋਲ ਤਾਂ ਬੜਾ ਵਧੀਆ ਫੇਸ਼ੀਅਲ ਆਇਆ ਹੈਗਾ ਵਾ ਤੁਸੀਂ ਉਹ ਕਰਵਾ ਸਕਦੇ ਹੋ ਜਿਹੜਾ ਦੇ ਨਾਲ ਤੁਹਾਡੇ ਪਿੰਪਲ ਐਕਨੇ ਅਤੇ ਡਾਰਕ ਸਰਕਲ ਸਾਰੇ ਰੀਮੂਵ ਹੋ ਜਾਣਗੇ ਅਤੇ ਗਲੋ ਵੀ ਆਜੇਗਾ ਉਹਨਾਂ ਦੇ ਤੁਹਾਨੂੰ ਤਿੰਨ ਸੋ ਤੋਂ ਪੰਜ ਸੌ ਦੇ ਵਿੱਚ ਪੈ ਜੇਗਾ ਹਾਂ ਹਾਂ ਕੋਈ ਨੀ ਤੁਸੀਂ ਆ ਜਾਓ ਮੇਰੇ ਕੋਲ ਹੋਰ ਵੀ ਸਪੈਸ਼ਲ ਔਫਰਸ ਹੈਗੇ ਆ ਅਤੇ ਤੁਸੀਂ ਰੈਗੂਲਰ ਕਸਟਮਰ ਹੈਗੇ ਹੋ ਅਤੇ ਮੈਂ ਤੁਹਾਨੂੰ ਡਿਸਕਾਊਂਟ ਵੀ ਦੇ ਦੁੰਗੀ ਆਪਾਂ ਡਿਸਕਸ ਕਰ ਲੈਦੇ ਜਦੋਂ ਤੁਸੀਂ ਆਓਗੇ